ਹੈਲੋ ਹਾਂਜੀ ਨਮਸਤੇ ਜੀ ਬਸ ਠੀਕ ਹੈ ਜੀ ਤੁਸੀਂ ਸੁਣਾਓ

ਪਠਾਨਕੋਟ ਵਿੱਚ ਜਿਹੜੀ ਵੱਧਦੀ ਭੀੜ ਇਹਦੇ ਬਾਰੇ ਕੁਝ ਡਿਸਕਸ ਕਰੀਏ ਕੀ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਬਹੁਤ ਹੀ ਟਰੈਫ਼ਿਕ ਹੁੰਦੀ ਹੈ ਮੈਂ ਵੀ ਸਕੂਲ ਜਾਣਾ ਹੁੰਦਾ ਤੇ ਰਸਤੇ ਸ਼ਾਹਪਰ ਚੌਂਕ ਵਿੱਚ ਵੀ ਇੰਨਾ ਜਾਮ ਲੱਗਿਆ ਦਾ ਹੁੰਦਾ ਕਿ ਉੱਥੇ ਮੈਂ ਅੱਧਾ ਘੰਟਾ ਲੇਟ ਹੋ ਹੀ ਜਾਂਦੀ ਹਾਂ ਰੋਜ਼ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਗਾਂਧੀ ਚੌਂਕ ਵਿੱਚ ਵੀ ਬੜੀ ਜ਼ਿਆਦਾ ਭੀੜ ਭੜੱਕਾ ਹੁੰਦਾ ਉੱਥੇ ਤਾਂ ਕੋਈ ਅ ਐਤਵਾਰ ਵਾਲੇ ਦਿਨ ਤਾਂ ਕੋਈ ਲੰਘ ਨਹੀਂ ਸਕਦਾ ਉੱਧਰੋਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਜੀ ਠੀਕ ਹੈ ਫਿਰ ਓਕੇ